ਪੰਜਾਬ ਵਿੱਚ ਕਾਫੀ ਇੱਦਾਂ ਦੀਆਂ ਸਟੈਮਨੀ ਸੰਸਥਾਵਾਂ ਨੇ ਜਿਹਦੇ ਵਿੱਚ ਸਾਇੰਸ ਟੈਕਨੋਲਜਿੰਗ ਅਤੇ ਮੈਥ ਰਿਗਾਰਡਿੰਗ ਕਾਫੀ ਜ਼ਿਆਦਾ ਜਿਹੜੀ ਹੈਗੀ ਸਟੱਡੀ ਕਰਾਈ ਜਾਂਦੀ ਆ ਇਹ ਇਹਦੇ ਵਿੱਚ ਕੁਛ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਗੌਰਮੈਂਟ ਦੀਆਂ ਨੇ ਸਰਕਾਰੀ ਨੇ ਕੁਛ ਪ੍ਰਾਈਵੇਟ ਵੀ ਨੇ ਅਤੇ ਇਸ ਤਰੀਕੇ ਨਾਲ ਕਾਫੀ ਇਹ ਸਨ ਜਿਹਦੇ ਵਿੱਚ ਮੁੱਖ ਆ ਜਾਂਦੀ ਆ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਜਾਂਦੀ ਇੱਥੋਂ ਯੂਕਡ ਡਿਪਾਰਟਮੈਂਟ ਹੈ ਇੰਜਨੀਅਰਿੰਗ ਡਿਪਾਰਟਮੈਂਟ ਹੈ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਆਈ ਆਈ ਟੀ ਰੋਪੜ ਹੈ ਇਹ ਆਪਣੇ ਪੂਰੇ ਇੰਡੀਆ ਲੈਵਲ ਪਰ ਫੇਮਸ ਹੈ ਆਈ ਆਈ ਟੀ ਦੇ ਪੁਆਇੰਟ ਤੋਂ ਜੀ ਐੱਨ ਡੀ ਜਿਹੜੀ ਹੈਗੀ ਆ ਅੰਮ੍ਰਿਤਸਰ ਦੇ ਵਿੱਚ ਹੈ ਚਿਤਕਾਰਾ ਯੂਨੀਵਰਸਿਟੀ ਹੈ ਇਹ ਪ੍ਰਾਈਵੇਟ ਜਿਹੜੀ ਹੈਗੀ ਆ ਐਂਟਰ ਕੋਆਨਸ਼ਿਪ ਦੀ ਆ ਜਾਂਦੀ ਆ ਐੱਲ ਪੀ ਯੂ ਹੈ ਠੀਕ ਆ ਇਹ ਸੰਸਥਾਵਾਂ ਆ ਜਾਂਦੀਆਂ ਇਸ ਤੋਂ ਇਲਾਵਾ ਇੱਕ ਸਲਾਈਟ ਹੈ ਲੋਂਗੋਵਾਲ ਦੇ ਵਿੱਚ ਇੰਜ਼ਨੀਅਰਿੰਗ ਦੇ ਪੁਆਇੰਟ ਔਫ ਵਿਊ 'ਤੇ ਇਸ ਤਰੀਕੇ ਨਾਲ ਕਾਫੀ ਜ਼ਿਆਦਾ ਸੰਸਥਾਵਾਂ ਥਾਪਰ ਹੈ ਇੰਜ਼ਨੀਅਰਿੰਗ ਦਾ ਕੋਲੇਜ ਅਤੇ ਇਹ ਸੰਸਥਾਵਾਂ ਜਿਹੜੀਆਂ ਹੈਗੀਆਂ ਆਪਣੀਆਂ ਸਾਇੰਸ ਟੈਕਨੋਲਜੀ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਆਪਣਾ ਕਾਫੀ ਜ਼ਿਆਦਾ ਯੋਗਦਾਨ ਪਾਉਂਦੀਆਂ ਹਨ